ਗੱਤਕਾ ਖੇਡ ਬਹੁਤ ਜ਼ਿਆਦਾ ਮਨੋਰੰਜਨ ਗਤੀਵਿਧੀ ਹੈ ਜੋ ਰੋਪਨਿਗ ਰੂਪਨਗਰ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ ਇਸ ਨ ਇਸ ਦੇ ਨਾਲ ਨਾਲ ਹੀ ਲੋਕ ਗਿੱਧਾ ਭੰਗੜਾ ਪਾ ਕੇ ਜ਼ਿਲ੍ਹੇ ਦੇ ਵਿੱਚ ਭਾਈਚਾਰੇ ਦੀ ਭਾਵਨਾ ਯੋਗਦਾਨ ਪਾਉਂਦੇ ਹਨ ਅਤੇ ਇਸ ਨਾਲ ਸਾਡੀ ਸੱਭਿਆਚਾਰ ਇੱਕਠੀ ਹੁੰਦੀ ਹੈ ਅਤੇ ਲੋਕ ਇੱਕ ਦੂਜੇ ਨਾਲ ਭਾਈਚਾਰਾ ਹ ਭਾਈਚਾਰਾ ਉਪਲਬਧ ਹੁੰਦਾ ਹੈ ਅਤੇ ਇੱਕ ਦੂਜੇ ਨਾਲ ਸਬੰਧਿਤ ਰਹਿੰਦੇ ਹਨ